ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਤੁਸੀਂ ਪ੍ਰ ਪ੍ਰਗਤੀ ਬੋਲ ਰਹੇ ਹੋ ਓ ਓਕੇ ਮੈਮ ਮੈਮ ਮੈਂ ਨਾ ਕੱਲ੍ਹ ਆਈ ਸੀਗੀ ਮੈਂ ਮੇਰਾ ਨਾਮ ਸ਼ਿਵਾਨੀ ਹੈ ਸ਼ਿਵਾਨੀ ਸ਼ਰਮਾ ਮੇਰਾ ਇੱਕ ਸੌ ਚਾਲੀ ਸੀਗਾ ਮੈਂ ਡਾਕਟਰ ਨੂੰ ਮਿਲੀ ਸੀਗੀ ਕੱਲ੍ਹ ਉਹਨਾਂ ਨੇ ਨਾ ਮੇਰੇ ਕੁਛ ਟੈਸਟ ਕੀਤੇ ਸੀਗੇ ਉਹ ਕਹਿ ਰਹੇ ਸੀ ਕਿ ਕੱਲ੍ਹ ਤੱਕ ਰਿਪੋਰਟ ਆ ਜਾਵੇਗੀ ਪਰ ਮੈਂ ਆਈ ਸੀ ਹੋਸਪਿਟਲ ਅੱਜ ਆਈ ਨਹੀਂ ਰਿਪੋਟ ਤੁਸੀਂ ਦੱਸ ਸਕਦੇ ਹੋ ਕਦੋਂ ਤੱਕ ਆਵੇਗੀ ਅਲਟ੍ਰਾਸਾਊਂਡ ਮੈਮ ਉਹ ਕੀ ਹੁੰਦਾ ਦੱਸੋੋਗੇ ਅੱਛਾ ਮੈਮ ਅਤੇ ਮੈਮ ਇਹਦੇ 'ਚ ਕੋਈ ਮਤਲਬ ਘਬਰਾਉਣ ਵਾਲੀ ਗੱਲ ਤਾਂ ਨਹੀਂ ਹੈਗੀ ਅੱਛਾ ਮੈਮ ਮੈਮ ਵੈਸੇ ਰਿਪੋਰਟ 'ਚ ਆਇਆ ਕੀ ਸੀਗਾ ਵੈਸੇ ਨੋਰਮਲ ਹੈ ਸਭ ਕੁਝ ਕਿ ਨਹੀਂ ਅੱਛਾ ਮੈਮ ਮੈਮ ਜਿਵੇਂ ਮੈਂ ਪਹਿਲਾਂ ਵੀ ਆਈ ਸੀਗੇ ਅਤੇ ਕਈ ਵਾਰ ਡਾਕਟਰ ਹੁੰਦੇ ਵੀ ਨਹੀਂ ਮਤਲਬ ਇਹਨਾਂ ਦਾ ਅਪੋਆਇੰਟਮੈਂਟ ਵਗੈਰਾ ਕਦੋਂ ਲੈਣਾ ਪਵੇਗਾ ਓਕੇ ਮੈਮ ਓਕੇ ਮੈਮ ਮੈਮ ਵੈਸੇ ਇਹਦੇ 'ਚ ਕੋਈ ਪਰਹੇਜ਼ ਕਰਨ ਦੀ ਲੋੜ ਤਾਂ ਨਹੀਂ ਹੈਗੀ ਇਸ ਵਿੱਚ ਅੱਛਾ ਮੈਮ ਓਕੇ ਮੈਮ ਮੈਮ ਹੋਰ ਓਕੇ ਮੈਮ ਮੈਮ ਹੋਰ ਕੋਈ ਮਤਲਬ ਇਸ ਨਾਲ ਕੋਈ ਖਤਰਾ ਤਾਂ ਨਹੀਂ ਹੈਗਾ ਮਤਲਬ ਸਹੀ ਹੁੰਦਾ ਇਹ ਅਲਟ੍ਰਾਸਾਊਂਡ ਅੱਛਾ ਓਕੇ ਮੈਮ ਓਕੇ ਓਕੇ ਮੈਮ ਠੀਕ